ਸਾਨੂੰ ਤਾਂ ਸਾਰੇ ਹੀ ਤਾਰੇ ਜੋ ਹੈ ਆਕਾਸ਼ ਵਿੱਚ ਉਹ ਬਹੁਤ ਹੀ ਸੋਹਣੇ ਲੱਗਦੇ ਹਨ ਅਤੇ ਆਕਰਸ਼ਿਤ ਕਰਦੇ ਨਜ਼ਰ ਆਉਂਦੇ ਹਨ ਕਿਉਂਕਿ ਜਦੋਂ ਆਕਾਸ਼ ਵਿੱਚ ਤਾਰਿਆਂ ਵੱਲ ਦੇਖਿਆ ਜਾਂਦਾ ਹੈ ਤਾਂ ਬੰਦਾ ਖੁਦ ਹੀ ਉਹਨਾਂ ਵੱਲ ਮੋਹ ਜਾਂਦਾ ਹੈ ਕਿਉਂਕਿ ਤਾਰੇ ਬਹੁਤ ਹੀ ਜਦੋਂ ਕਾਲੀ ਰਾਤ ਪੈਂਦੀ ਹੈ ਤਾਂ ਬਹੁਤ ਹੀ ਟਿਮਟਿਮਾਉਂਦੇ ਸੋਹਣੇ ਲੱਗਦੇ ਹਨ ਅਤੇ ਜੇ ਆਪਾਂ ਗ੍ਰਹਿ ਦੀ ਗੱਲ ਕਰੀਏ ਤਾਂ ਸ਼ੁੱਕਰ ਗ੍ਰਹਿ ਜੋ ਹੈ ਉਹ ਬਹੁਤ ਹੀ ਲੋਕਾਂ ਨੂੰ ਅਟਰੈਕਟ ਕਰਦਾ ਹੈ ਕਿਉਂਕਿ ਉਹ ਜੋ ਹੈ ਉਹ ਸੁੰਦਰਤਾ ਦਾ ਕਹਿ ਸਕਦੇ ਹਾਂ ਵੀ ਇੱਕ ਵਧੀਆ ਗ੍ਰਹਿ ਹੈ ਅਤੇ ਲੋਕ ਜੋ ਹੈ ਇਸ ਵੱਲ ਜਲਦੀ ਅਟਰੈਕਟ ਹੋ ਜਾਂਦੇ ਹਨ ਅਤੇ ਜੇ ਆਪਾਂ ਤਾਰਿਆਂ ਦੀ ਗੱਲ ਕਰੀਏ ਤਾਰੇ ਤਾਂ ਜਦੋਂ ਰਾਤ ਪੈਂਦੀ ਹੈ ਤਾਂ ਜਦੋਂ ਟਿਮਟਮਾਉਂਦੇ ਹਨ ਜਿਹੜੇ ਤਾਰੇ ਜ਼ਿਆਦਾ ਟਿਮਟਮਾਉਂਦੇ ਹਨ ਉਹ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ